ਹੈਲੋ ਹਾਂਜੀ ਬ ਹਾਂਜੀ ਬਲਜੀਤ ਸਿੰਘ ਬੋਲ ਰਿਹਾ ਹਾਂ ਜੀ ਸਰ ਇੱਕ ਆਪਣੇ ਕੰਪਿਊਟਰ ਆ ਉਹਦੀ ਸਕਰੀਨ ਟੁੱਟ ਗਈ ਜੀ ਐਲ ਈ ਡੀ ਦੀ ਅਤੇ ਉਹ ਜ ਕਿਸੇ ਬੱਚੇ ਨੇ ਮਾਰਿਆ ਜੀ ਕੁਛ ਵਿੱਚ ਅਤੇ ਤਰੇੜ ਜਿਹੀ ਆ ਗਈ ਆ ਕਾਫੀ ਹੁਣ ਉਹ 'ਚ ਉਹ ਕਾਲੀ ਜਿਹੀ ਹੋ ਜਾਂਦੀ ਆ ਜੀ ਸਾਰੀ ਕਾਲੀ ਜਿਹੀ ਹੋ ਜਾਂਦੀ ਆ ਜੀ ਕੁਛ ਨਹੀਂ ਦੀਂਦਾ ਹੁਣ ਕੀ ਇਹ ਨਵੀਂ ਪਊ ਇਹ ਸੈਮਸੰਗ ਦੀ ਆ ਜੀ ਇਹ ਹੋਵੇਗੀ ਸੋਲਾਂ ਕੁ ਪੰਦਰ ਸ ਪੰਦਰਾਂ ਹੋਊ ਬਸ ਪੰਦਰਾਂ ਸੋਲਾਂ ਹਾਂਜੀ ਇਹ ਪੁਰਾਣੀ ਹੈਗੀ ਆ ਜੀ ਦਸ ਕੁ ਸਾਲ

ਅੱਛਾ ਅੱਛਾ ਅੱਛਾ ਅੱਛਾ ਫਿਰ ਨਵੀਂ ਕਿੰਨੇ ਕੁ ਦੀ ਪੈ ਜੂ ਅੱਛਾ ਸਤਾਰਾਂ ਇੰਚੀ ਕਿੰਨੇ ਦੀ ਪੈ ਜੂ ਕਿੰਨੇ ਕੁ ਦੀ ਪੈ ਜੂ ਜੀ ਕੋਈ ਅੱਛਾ ਅਲੱਗ ਅਲੱਗ ਅਲੱਗ ਅਲੱਗ ਰੇਟ ਹੋਣਗੇ ਇਹਨਾਂ ਦੇ ਕਿ

ਅੱਛਾ ਅੱਛਾ ਜੀ ਕੰਪਿਊਟਰ ਵੀ ਯੂਜ਼ ਕਰ ਲੈਂਦੇ ਹਾਂ ਜੀ ਕੈਮਰੇ ਵੀ ਲੱਗਿਆ ਹੋਇਆ ਦੋਨਾਂ 'ਚ ਹੀ ਵਰਤ ਲੈਂਦੇ ਹਾਂ ਅੱਛਾ ਅੱਛਾ

ਅੱਛਾ ਅੱਛਾ ਫਿਰ ਅਸੀਂ ਇਹ ਅੱਡ ਇਕੱਲਾ ਕੰਪਿਊਟਰ ਲਈ ਕਰ ਲੈਂਦੇ ਹਾਂ ਫਿਰ ਛੋਟੀ ਲੈ ਲੈਂਦੇ ਹਾਂ ਠੀਕ ਆ ਜੀ ਠੀਕ ਹੈ ਠੀਕ ਹੈ ਚਲੋ ਠੀਕ ਆ ਹਾਂਜੀ ਫਿਰ ਅਸੀਂ ਦੁਕਾਨ 'ਤੇ ਆਉਂਦੇ ਹਾਂ ਜੀ ਚੱਕ ਕੇ ਲਿਆਉਂਦੇ ਹਾਂ ਉਹ ਵਿੱਚ ਰੱਖ ਲੋਂਗੇ ਹਾਂ ਕੱਲ੍ਹ ਨੂੰ ਆ ਜਾਵਾਂਗੇ ਠੀਕ ਹਾਂਜੀ ਓਕੇ ਜੀ ਠੀਕ ਆ ਜੀ ਓਕੇ ਜੀ ਓਕੇ